ਹੈਲੋ ਹਰਬੰਸ ਐਤਕੀ ਵਾਰੀ ਝੋਨੇ ਝਾਨੇ ਦਾ ਪ੍ਰੋਗਰਾਮ ਕਿਹੜੇ ਬੀਜ ਦਾ ਆਹ ਤੀਹ ਇਕੱਤੀ ਤੀਹ ਇਕੱਤੀ ਵੀ ਆਏ ਹੋਏ ਆ ਊਂ ਛੱਬੀ ਦਾ ਆਏਂ ਵੀ ਸਮਾਂ ਥੋੜ੍ਹਾ ਜਿਹਾ ਘੱਟ ਹੁੰਦਾ ਜਿਹੜੇ ਆਪਾਂ ਪਹਿਲਾਂ ਤੋਂ ਦੋ ਸੌ ਬਾਰਾਂ ਵਗੈਰਾ ਲਾਉਂਦੇ ਹਾਂ ਉਹਨਾਂ ਦਾ ਸਮਾਂ ਥੋੜ੍ਹਾ ਜਿਹਾ ਵੱਧ ਹੁੰਦਾ ਹਾਂ ਅਸਲ ਦੇ ਵਿੱਚ ਨਾ ਆਪਾਂ ਨੂੰ ਇੱਕੋ ਹੀ ਵਰਾਇਟੀ ਨਹੀਂ ਲਾਉਣੀ ਚਾਹੀਦੀ ਜਿਹੜਾ ਮੇਰਾ ਮੇਰਾ ਅੰਦਾਜ਼ਾ ਨਾ ਵੀ ਕਿਸੇ ਖੇਤ 'ਚ ਉਹ ਲਾ ਦਿਉ ਕਿਸੇ 'ਚ ਉਹ ਲਾ ਦਿਉ ਕੋਈ ਇੱਕ ਮਾੜਾ ਰਹਿ ਗਿਆ ਤਾਂ ਇੱਕ ਚੰਗਾ ਵੀ ਹੋ ਜੇ ਕਿਉਂਕਿ ਆਖਿਰ ਤਾਂ ਫੇਰ ਸਾਰਾ ਕੁਝ ਬੱਝਿਆ ਹੋਇਆ ਤਾਂ ਪੈਸੇ ਨਾਲ ਹੀ ਹੈ ਨਾ ਜੇ ਜੇ ਜੇ ਆਪਣੇ ਕੋਲ ਮੰਨ ਲਉ ਇੱਕੋ ਹੀ ਹੈ ਵੀ ਤੁਸੀਂ ਸਾਰਾ ਇੱਕ ਸੌ ਛੱਬੀ ਲਾ ਤਾ ਕੋਈ ਨਾ ਕੋਈ ਗੱਲ ਹੋ ਗਈ ਜਿਵੇਂ ਪਿੱਛੇ ਜਿਹੇ ਇੱਕ ਸੌ ਅਠਾਈ ਨਹੀਂ ਖਰਾਬ ਹੋਏ ਸੀ ਦੋ ਸਾਲ ਪਹਿਲਾਂ ਹਾਂ ਅਤੇ ਉਦੋਂ ਉਦੋਂ ਫੇਰ ਇਹ ਸਮੱਸਿਆ ਆ ਗਈ ਜਿਨ੍ਹਾਂ ਕੋਲ ਬਦਲਵੇਂ ਸੀ ਵੀ ਦੋ ਕਿੱਲੇ ਚਲ ਖਰਾਬ ਹੋ ਗਏ ਤਾਂ ਯਾਰ ਦੂਜੇ ਕਿੱਲੇ ਤਾਂ ਬਚੇ ਰਹਿ ਗਏ ਇੱਕੋ ਹੀ ਇੱਕੋ ਹੀ ਵਰਾਇਟੀ ਲਾਉਣੀ ਹਮੇਸ਼ਾ ਹੀ ਚੰਗੀ ਨਹੀਂ ਹੁੰਦੀ ਦੋ ਜਾਂ ਤਿੰਨ ਤਾਂ ਜ਼ਰੂਰੀ ਹੈ ਇੱਕ ਸੌ ਛੱਬੀ ਦਾ ਤਾਂ ਐਂ ਆ ਸਮਾਂ ਘੱਟ ਹੈ ਉਹ ਦੂਸਰੇ ਦਾ ਲਾਉਣ ਦਾ ਇਹ ਫਾਇਦਾ ਹੋ ਜਾਂਦਾ ਵੀ ਹੁਣ ਲੇਬਰ ਲੁਬਰ ਦੀ ਸੌਖ ਹੈ ਉਦੋਂ ਉਦੋਂ ਮੌਕੇ 'ਤੇ ਆ ਕੇ ਆਪਾਂ ਨੂੰ ਛੱਬੀ ਵੇਲੇ ਲੇਬਰ ਦੀ ਤਾਂ ਉੱਧਰੋਂ ਮੌਨਸੂਨ ਉਦੋਂ ਜ਼ੋਰ ਫੜ ਜਾਂਦੀ ਹੈ ਉਹ ਇਹਦਾ ਨਹੀਂ ਪਤਾ ਵੀ ਵਰਖਾ ਹੀ ਇੰਨੀ ਜ਼ਿਆਦਾ ਹੋ ਜੇ ਵੀ ਤੁਹਾਨੂੰ ਲਾਉਂਦਿਆ ਲਾਉਂਦਿਆ ਹੀ ਰੋਕ ਦੇਵੇ ਪੰਜ ਦਿਨ ਸਾਰੀ ਹਾਂ ਹਾਂ ਹਾਂ ਰਲਵਾਂ ਮਿਲਵਾਂ ਰਲਵੇਂ ਮਿਲਵੇਂ 'ਚ ਆਪਾਂ ਮਤਲਬ ਹਾਂ ਬੀਜ ਤਾਂ ਵਾਧੂ ਮਿਲਦੇ ਹੈਗੇ ਆ ਬੀਜ ਦੀ ਕੋਈ ਐਡੀ ਲੰਬੀ ਚੌੜੀ ਦਿੱਕਤ ਨਹੀਂ ਥੋੜ੍ਹਾ ਜਿਹਾ ਦੋ ਰੁਪਈਏ ਵੱਧ ਲੱਗ ਜਾਣਗੇ ਬਟ ਬੀਜ ਤਾਂ ਵਾਧੂ ਮਿਲਦੇ ਹੈਗੇ ਹਾਂ ਅਤੇ ਬਾਕੀ ਜਿਹੜਾ ਦੋ ਸੌ ਬਾਰਾਂ ਅਤੇ ਛੱਬੀ ਦਾ ਇਹ ਕਿਹੜਾ ਹਾਈਬ੍ਰੈਡ ਹੈ ਵੀ ਬੀਜ ਨਹੀਂ ਇਹ ਤਾਂ ਇੱਥੇ ਪਿੰਡਾਂ 'ਚ ਕਿਸੇ ਤੋਂ ਇੱਕ ਦੂਜੇ ਤੋਂ ਲੈ ਲਉ ਕੋਈ ਐਡੀ ਸਮੱਸਿਆ ਨਹੀਂ ਯਾਰ ਛੱਬੀ ਵੀਹ ਤਾਂ ਮੇਰੇ ਕੋਲ ਵੀ ਪਿਆ ਮੈਂ ਵੀ ਦੇ ਸਕਦਾ ਥੋੜ੍ਹਾ ਜਿਹਾ ਪਰ ਥੋੜ੍ਹਾ ਜਿਹਾ ਪਰ ਕਿਸੇ ਮਤਲਬ ਛੋਟੇ ਹਾਂ ਹਾਂ ਦੋ ਚਾਰ ਦੋ ਚਾਰ ਪੰਜ ਕਿੱਲਿਆਂ ਵਾਲੇ ਵਾਸਤੇ ਉਹ ਜਿਹੇ ਦਾ ਅਰਥ ਆਪਾਂ ਸਾਰ ਦਿਆਂਗੇ ਅਤੇ ਐਂ ਹੁੰਦੀ ਹੈ ਹਾਂ ਅਤੇ ਦੂਜਾ ਜਿਹੜਾ ਜਿਹੜੀ ਲੰਬੀ ਵਰਾਇਟੀ ਹੈ ਲੰਬੇ ਜਿਵੇਂ ਪੂਸਾ ਪਾਸ਼ਾ ਉਹ ਜ਼ਰੂਰ ਨਿਕਲ ਜਾਵੇ ਆਉਂਦਿਆਂ ਸਮਾਂ ਬਹੁਤ ਜ਼ਿਆਦਾ ਲੈ ਲੈਂਦੇ ਹੈ ਪਾਣੀ ਦੀ ਖਪਤ ਬੈਨ ਵੀ ਤਾਂ ਇੱਕ ਇਹ ਵੀ ਹੈ ਨਾ ਉਹਨਾਂ ਦਾ ਇਹ ਨਹੀਂ ਪਤਾ ਉਹਨਾਂ ਨੂੰ ਕੋਈ ਖਾਸ ਕਿਸਮ ਦੀ ਬਿਮਾਰੀ ਪਤਾ ਨਹੀਂ ਕਦੋਂ ਆ ਜੇ ਅਤੇ ਜਮ੍ਹਾਂ ਇੱਕਦਮ ਫੇਲ੍ਹ ਹੋਜੇ ਕਿਉਂਕਿ ਉਹ ਯੂਨੀਵਰਸਿਟੀ ਤੋਂ ਹਾਂ ਯੂਨੀਵਰਸਿਟੀ ਤੋਂ ਪ੍ਰਾਪਤ ਹਾਂ ਮ ਨਹੀਂ ਹੈ ਮਾਨਤਾ ਪ੍ਰਾਪਤ ਨਹੀਂ ਹੈ ਅਤੇ ਉਹ ਉਹ ਉਹ ਤੁਹਾਨੂੰ ਸਮੱਸਿਆ ਆ ਸਕਦੀ ਹੈ ਉਹ ਤਾਂ ਉਹ ਤੋਂ ਤਾਂ ਟਾਲਾ ਹੀ ਰੱਖੋ ਉਹ ਉਹ ਵੀ ਉਹਦੀ ਜਗ੍ਹਾ ਤਾਂ ਸਗੋਂ ਉਹਦੀ ਐਂ ਜਿਹੜੀ ਹੈਗੀ ਹੈ ਆਪਣੀ ਬਾਸਮਤੀ ਇੱਕ ਇੱਕ ਹਿੱਸਾ ਇਹ ਇਹ ਲਾ ਲਉ ਚਲੋ ਆਪਾਂ ਮਿਲਦੇ ਹਾਂ ਸ਼ਾਮ ਨੂੰ ਫੇਰ ਹੈਂ ਚੰਗਾ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ